ਮੈਂ ਰਜੇਸ਼ ਕੁਮਾਰ ਵਾਸੀ ਫਿਰੋਜਪੁਰ ਕਲਾਂ ਪਠਾਨਕੋਟ ਦਾ ਵਾਸੀ ਹਾਂ ਮੈਂ ਇਹ ਗੱਲ ਕਹਿੰਦਾ ਹਾਂ ਕਿ ਪੁਰਾਣੇ ਸਮੇਂ ਵਿੱਚ ਲੋਕ ਬਾਲਣ ਬਾਲ ਕੇ ਆਪਣੀ ਰੋਜ਼ੀ ਰੋਟੀ 'ਤੇ ਨਿਰਭਰ ਕਰਦੇ ਸਨ ਪਰ ਅੱਜ ਵਿਗਿਆਨਿਕ ਯੁੱਗ ਦੇ ਕਾਰਣ ਲੋਕ ਬਿਜਲੀ 'ਤੇ ਨਿਰਭਰ ਹੋ ਗਏ ਹਨ ਕਈਆਂ ਨੇ ਘਰ ਵਿੱਚ ਬਿਜਲੀ ਦੇ ਹੀਟਰ ਜਾਂ ਗੈਸ ਗੈਸੀ ਚੁੱਲ੍ਹਾ ਜਾਂ ਹੋਰ ਕਈ ਤਰ੍ਹਾਂ ਦੇ ਸਾਧਨ ਰੱਖੇ ਹਨ ਪਰ ਅੱਜ ਅਗਰ ਬਿਜਲੀ ਚਲੀ ਜਾਵੇ ਤਾਂ ਲੋਕਾਂ ਕੋਲ ਇੱਕ ਬੜੀ ਹੀ ਵਧੀਆ ਕਾਢ ਹੈ ਜੋ ਕਿ ਇਨਵਰਟਰ ਹੈ ਇਨਵਰਟਰ ਦੇ ਦੌਰਾਨ ਉਹ ਆਪਣੇ ਕੋਲ ਬਿਜਲੀ ਸਟੋਰ ਕਰਕੇ ਰੱਖ ਸਕਦਾ ਹੈ ਅਤੇ ਬਿਜਲੀ ਚਲੇ ਜਾਣ 'ਤੇ ਉਹ ਲੋਕਾਂ ਨੂੰ ਸਹਿਯੋਗ ਦੇ ਕੇ ਉਸਨੂੰ ਉਹਨਾਂ ਦੀ ਕਾਰਗੁਜ਼ਾਰੀ ਨੂੰ ਪੂਰਾ ਕਰਦਾ ਹੈ ਧੰਨਵਾਦ